ਨਵੇਂ ਜਨਮੇ ਬੱਚਿਆਂ ਦੀ ਦੇਖਭਾਲ ਕਰਨੀ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਉਹਨਾਂ ਦਿਨਾਂ ਵਿੱਚ ਸਾਨੂੰ ਉਹਨਾਂ ਦਾ ਖਿਆਲ ਬਹੁਤ ਰੱਖਣਾ ਚਾਹੀਦਾ ਹੈ ਰੋਜ਼ ਹੀ ਉਹਨਾਂ ਨੂੰ ਸਾਫ ਸੁਥਰੇ ਕੱਪੜੇ ਪਾਉਣੇ ਚਾਹੀਦੇ ਹਨ ਉਹਨਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਣੇ ਚਾਹੀਦੇ ਹਨ ਉਹਨਾਂ ਨੂੰ ਹਮੇਸ਼ਾਂ ਹੀ ਸਿਆਲ ਵਿੱਚ ਮੋਟੇ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ ਗਰਮੀਆਂ ਵਿੱਚ ਖਾਸ ਧਿਆਨ ਰੱਖਣਾ ਹੈ ਕਿ ਉਹਨਾਂ ਨੂੰ ਅਸੀਂ ਪੱਖੇ ਜਾਂ ਏਸੀ ਵਿੱਚ ਧਿਆਨ ਨਾਲ ਪਾਈਏ ਕਿ ਉਹਨਾਂ ਨੂੰ ਨਾ ਹੀ ਠੰਡ ਲੱਗੇ ਅਤੇ ਨਾ ਹੀ ਗਰਮੀ ਉਹਨਾਂ ਦਾ ਖਾਣ ਪੀਣ ਵੱਲ ਧਿਆਨ ਬਹੁਤ ਹੀ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਜ਼ਿਆਦਾਤਰ ਮਾਂ ਦਾ ਦੁੱਧ ਹੀ ਪਿਆਉਣਾ ਚਾਹੀਦਾ ਹੈ ਛੇ ਮਹੀਨਿਆਂ ਬਾਅਦ ਆਪਾਂ ਉਹਨਾਂ ਦੀ ਖੁਰਾਕ ਵਿੱਚ ਵਾਧਾ ਕਰ ਸਕਦੇ ਹਨ ਜਿਵੇਂ ਕਿ ਆਪਾਂ ਉਹਨਾਂ ਨੂੰ ਦਲੀਆ ਖਿਚੜੀ ਜੂਸ ਵਗੈਰਾ ਪਿਆ ਸਕਦੇ ਹਨ ਜਿਸ ਨਾਲ ਉਹਨਾਂ ਦੇ ਵਾਧੇ ਵਿੱਚ ਕੁਛ ਵਾਧਾ ਪਵੇ